ਨਮਸਤੇ ਮੈਮ ਮੈਮ ਆਪਣਾ ਆਜ਼ਾਦੀ ਦਿਵਸ ਆ ਰਿਹਾ ਫਿਰ ਕਿਹੜੀ ਕਿਹੜੀ ਕਲਾਸ ਦੇ ਸਟੂਡੈਂਟਸ ਪਾਰਟੀਸਪੇਟ ਕਰ ਰਹੇ ਆ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਆਪਾਂ ਸਕੂਲ ਵਿੱਚ ਮਨਾਵਾਂਗੇ ਕਿ ਬਾਹਰ ਦਾਣਾ ਮੰਡੀ ਵਗੈਰਾ ਤੇ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਫਿਰ ਉਹ ਥੋੜ੍ਹੇ ਵੱਡੇ ਵੀ ਹੋ ਜਾਂਦੇ ਆ ਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਮੈਂ ਲਿਸਟ ਬਣਾ ਲਈ ਆਪਾਂ ਬੱਚਿਆਂ ਦੀ ਜਿਹੜੇ ਜਿਹੜੇ ਜਾਣਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਪਰ ਮੈਮ ਦੂਸਰੇ ਸਕੂਲ ਦੇ ਬੱਚੇ ਵੀ ਕਹਿੰਦੇ ਦੂਸਰੇ ਸਕੂਲ ਦੇ ਬੱਚੇ ਵੀ ਆਣਗੇ ਹਾਂਜੀ ਮੈਡਮ ਹਾਂਜੀ ਹਾਂਜੀ ਮੈਮ ਪਰ ਮੈਮ ਹਾਂਜੀ ਹਾਂਜੀ ਮੈਮ ਜਿਹੜੀ ਉਹ ਡਿਵੀਜ਼ਨ ਆਉਗੀ ਆਪਾਂ ਫਾਸਟ ਸੈਕਿੰਡ ਕੱਢਾਂਗੇ ਆਪਾਂ ਬੱਚਿਆਂ ਨੂੰ ਠੀਕ ਹੈ ਮੈਡਮ ਓਕੇ